ਸਮੇਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਹੀ ਤਬਦੀਲੀਆਂ ਆਈਆਂ ਹਨ ਕਈ ਲੋਕ ਪੰਜਾਬ ਦੇ ਵਿੱਚ ਰਹਿ ਕੇ ਵੀ ਪੰਜਾਬੀ ਬੋਲਣ ਦੇ ਵਿੱਚ ਸੰਗ ਕਰਦੇ ਹਨ ਅਤੇ ਆਪਣੇ ਬੱਚਿਆਂ ਨੂੰ ਹਿੰਦੀ ਜਾਂ ਅੰਗਰੇਜ਼ੀ ਬੋਲਣ ਲਈ ਮਜਬੂਰ ਕਰਦੇ ਹਨ ਪੰਜਾਬੀ ਨੂੰ ਬੋਲਣ ਨਹੀਂ ਦਿੰਦੇ ਉਹਨਾਂ ਨੂੰ ਲੱਗਦਾ ਹੈ ਪੰਜਾਬੀ ਬੋਲਣ ਨਾਲ ਸਾਡੀ ਜਿਹੜੀ ਮਾਣ ਹੈ ਉਹ ਘੱਟਦਾ ਹੈ ਪਰ ਜਦ ਕਿ ਇਹ ਬਿਲਕੁਲ ਗਲਤ ਹੈ ਪੰਜਾਬੀ ਬੋਲਣ ਨਾਲ ਸਾਡਾ ਮਾਨ ਵੱਧਦਾ ਹੈ ਇਹ ਸਾਡੀ ਮਾਂ ਬੋਲੀ ਹੈ ਅਤੇ ਸਾਨੂੰ ਪੰਜਾਬੀ ਹੀ ਬੋਲਣੀ ਚਾਹੀਦੀ ਹੈ ਹੋਰ ਤਾਂ ਹੋਰ ਪੰਜਾਬ ਦੇ ਵਿੱਚ ਜਿਹੜੇ ਵੀ ਸਕੂਲ ਹਨ ਉਹਨਾਂ ਵਿੱਚ ਵੀ ਟੀਚਰਸ ਪੰਜਾਬੀ ਬੋਲਣ ਤੋਂ ਰੋਕਦੇ ਹਨ ਅੰਗਰੇਜ਼ੀ ਬੋਲਵਾਉਂਦੇ ਹਨ ਹਿੰਦੀ ਬੋਲਵਾਉਂਦੇ ਹਨ ਅਤੇ ਕਈ ਸਕੂਲਾਂ ਦੇ ਵਿੱਚ ਤਾਂ ਪੰਜਾਬੀ ਸਿਖਾਈ ਵੀ ਬਹੁਤ ਲੇਟ ਜਾਂਦੀ ਹੈ ਜੋ ਕਿ ਬਹੁਤ ਗਲਤ ਹੈ ਬੱਚਿਆਂ ਨੂੰ ਆਪਣੀ ਮਾਂ ਬੋਲੀ ਦਾ ਪਤਾ ਹੋਣਾ ਚਾਹੀਦਾ ਹੈ ਚੰਗੀ ਤਰ੍ਹਾਂ ਲਿਖਣੀ ਹੈ ਅਤੇ ਬੋਲਣੀ ਆਉਣੀ ਚਾਹੀਦੀ ਹੈ ਪਰ ਅੱਜ ਕੱਲ੍ਹ ਦੇ ਬੱਚੇ ਬਹੁਤ ਹੀ ਜ਼ਿਆਦਾ ਇਸ ਚੀਜ਼ ਤੋਂ ਦੂਰ ਹੋਣਗੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਗਿਣਤੀ ਤੱਕ ਬੋਲਣੀ ਨਹੀਂ ਆਉਂਦੀ ਪਰ ਕਿਤੇ ਕਿਤੇ ਕਈ ਕਈ ਮਾਂ ਬਾਪ ਇਹ ਵੀ ਹੁੰਦੇ ਆ ਜਿਹੜੇ ਕਿ ਆਪਣੇ ਬੱਚਿਆਂ ਨੇ ਪਹਿਲਾਂ ਪੰਜਾਬੀ ਹੀ ਸਿਖਾਉਂਦੇ ਹਨ ਤਾਂ ਮਾਂ ਬਾਪ ਨੂੰ ਸੋਚਣਾ ਚਾਹੀਦਾ ਹੈ ਕਿ ਪਹਿਲਾਂ ਪੰਜਾਬੀ ਹੀ ਸਿਖਾਉਣੀ ਚਾਹੀਦੀ ਹੈ ਫਿਰ ਕੋਈ ਹੋਰ ਭਾਸ਼ਾ ਕਿਉਂਕਿ ਇਹ ਸਾਡੀ ਮਾਂ ਬੋਲੀ ਹੈ ਅਤੇ ਸਾਨੂੰ ਇਸ 'ਤੇ ਮਾਣ ਹੋਣਾ ਚਾਹੀਦਾ ਹੈ